ਮੈਨੂੰ ਸ਼ੌਂਕ ਹੈ ਮੈਂ ਕੋਈ ਗਾਹਕਗਰੀ ਲਈ ਨਹੀਂ ਬੁਣਾਈ ਕਰਦੀ ਮੈਨੂੰ ਗਾਹਕਾਂ ਤੋਂ ਚੰਗੀ ਫੀਡਬੈਕ ਮਿਲਦੀ ਹੈ ਪਰ ਮੈਂ ਕੋਈ ਗਾਹਕ ਨਹੀਂ ਰੱਖਦੀ ਬਸ ਇੱਕ ਭਾਈਚਾਰੇ ਦੇ ਵਜੋਂ ਜਾਂ ਫਿਰ ਕਿਸੇ ਨੂੰ ਤੋਹਫਾ ਦੇਣਾ ਤਾਂ ਬਣਾ ਕੇ ਦੇ ਦਿੰਦੀ ਹਾਂ ਸਵੈਟਰ ਮੋਜੇ ਟੋਪੀਆਂ ਸਵੀਗੀ ਸਾਰਾ ਕੁਝ ਈਦ ਦੀਆਂ ਚੀਜ਼ਾਂ ਤਾਂ ਫਿਰ ਉਹ ਮੇਰੀ ਤਾਰੀਫ ਕਰਦੇ ਨੇ ਮੇਰੇ ਹੁਨਰ ਦੀ ਕਿ ਤੁਸੀਂ ਕਿੰਨਾ ਵਧੀਆ ਬੁਣ ਲੈਂਦੇ ਹੋ ਤੁਸੀਂ ਕਿੰਨਾ ਵਧੀਆ ਬਣਾ ਲੈਂਦੇ ਹੋ ਤਾਂ ਮੈਨੂੰ ਵਧੀਆ ਲੱਗਦਾ ਫਿਰ ਮੈਂ ਹੋਰ ਆਪਣੇ ਬੱਚਿਆਂ ਨੂੰ ਬਣਾ ਕੇ ਦਿੰਨੀ ਹਾਂ ਮੈਂ ਬਾਹਰੋਂ ਸਵੈਟਰ ਨਹੀਂ ਲੈਂਦੀ ਮੈਂ ਘਰੇ ਆਪਣੇ ਹੱਥਾਂ ਨਾਲ਼ ਬਣਾਏ ਪਾਉਂਦੀ ਹਾਂ